ਹੈਲੋ ਮੈਂ ਸਿਮਰਪ੍ਰੀਤ ਸਿੰਘ ਬੋਲ ਰਿਹਾ ਹਾਂ ਕੀ ਤੁਸੀਂ ਗੁਪਤਾ ਟਰਾਂਸਪੋਰਟ ਏਜੰਸੀ ਤੋਂ ਬੋਲ ਰਹੇ ਹੋ ਮੈਂ ਤੁਹਾਡੇ ਨਾਲ ਇੱਕ ਕੰਪਲੇਂਟ ਸਾਂਝੀ ਕਰਨਾ ਚਾਹੁੰਦਾ ਹਾਂ ਮੈਂ ਹਾਲ ਹੀ ਵਿੱਚ ਤੁਹਾਡੀ ਏਜੰਸੀ ਤੋਂ ਇੱਕ ਟੈਂਪੂ ਟਰੈਵਲਰ ਵੈਨ ਬੁੱਕ ਕੀਤੀ ਸੀ ਕਿਉਂਕਿ ਮੈਂ ਅਤੇ ਮੇਰੇ ਪਰਿਵਾਰ ਨੇ ਜੰਮੂ ਕਸ਼ਮੀਰ ਜਾਣ ਦਾ ਪਲੈਨ ਬਣਾਇਆ ਸੀ ਜਾਣ ਵਾਲੇ ਦਿਨ ਜਦੋਂ ਤੁਹਾਡਾ ਡਰਾਈਵਰ ਆਇਆ ਤਾਂ ਮੈਂ ਅਤੇ ਮੇਰੇ ਪਰਿਵਾਰ ਨੇ ਦੇਖਿਆ ਕਿ ਵੈਨ ਬਹੁਤ ਹੀ ਗੰਦੀ ਪਈ ਸੀ ਉਸਦੇ ਅੰਦਰ ਅਤੇ ਬਾਹਰ ਸਾਫ਼ ਸਫ਼ਾਈ ਦਾ ਥੋੜ੍ਹਾ ਵੀ ਧਿਆਨ ਨਹੀਂ ਦਿੱਤਾ ਸੀ ਗਿਆ ਵੈਨ ਦੇ ਸੀਟਾਂ ਦੇ ਕਵਰ ਫਟੇ ਹੋਏ ਸੀ ਅਤੇ ਕਰੋਨਾ ਵਾਲੇ ਟਾਈਮ ਵਿੱਚ ਵੀ ਡਰਾਈਵਰ ਨੇ ਮਾਸਕ ਨਹੀਂ ਸੀ ਪਾਇਆ ਇਹ ਸਾਰਾ ਕੁਝ ਦੇਖਦੇ ਹੋਏ ਮੈਂ ਮੇ ਮੇਰੇ ਪਰਿਵਾਰ ਨੇ ਜਾਣ ਤੋਂ ਮਨ੍ਹਾਂ ਕਰਤਾ ਅਤੇ ਮੈਂ ਉਸੇ ਟਾਈਮ ਤੁਹਾਡੇ ਕੰਪਨੀ ਨੂੰ ਸੂਚਿਤ ਕੀਤਾ ਸੀ ਕੰਪਲੇਂਟ ਪਾਈ ਸੀ ਪਰ ਉਹਨਾਂ ਵੱਲੋਂ ਕੋਈ ਰਿਸਪੋਂਸ ਨਹੀਂ ਸੀ ਆਇਆ ਮੈਂ ਤੁਹਾਡੀ ਫੁੱਲ ਪੇਅਮੈਂਟ ਪਹਿਲਾਂ ਤੋਂ ਹੀ ਕੀਤੀ ਹੋਈ ਸੀ ਪਰ ਫਿਰ ਵੀ ਮੈਂ ਹਾਰ ਕੇ ਉਸੇ ਟਾਈਮ ਦੂਸਰੀ ਏਜੰਸੀ ਤੋਂ ਵੈਨ ਬੁੱਕ ਕੀਤੀ ਮੈਂ ਤੁਹਾਡੇ ਕੰਪਨੀ ਦਾ ਨਾਮ ਸੁਣ ਕੇ ਹੀ ਤੁਹਾਡੇ ਤੋਂ ਵੈਨ ਬੁੱਕ ਕੀਤੀ ਸੀ ਪਰ ਮੈਂ ਤੁਹਾਡੇ ਇਸ ਬਿਹੇਵੀਅਰ ਤੋਂ ਬਹੁਤ ਹੀ ਨਿਰਾਸ਼ ਹਾਂ ਮੈਂ ਰਿਫੰਡ ਦੀ ਵੀ ਐਪਲੀਕੇਸ਼ਨ ਪਾਈ ਹੋਈ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਰਿਫੰਡ ਨੂੰ ਅਸੈਪਟ ਕਰੋਂਗੇ ਅਤੇ ਮੇਰੇ ਰਿਵਿਊ ਨੂੰ ਦੇਖ ਕੇ ਅੱਗੇ ਤੋਂ ਆਪਣੇ ਗ੍ਰਾਹਕਾਂ ਨੂੰ ਇਸ ਮੁਸੀਬਤਾਂ ਦਾ ਸਾਹਮਣਾ ਨਹੀਂ ਕਰਨ ਦੇਵੋਂਗੇ ਧੰਨਵਾਦ